ਹੈਲੋ ਹਾਂਜੀ ਹਾਂਜੀ ਗਾਇਡ ਕਰਦੇ ਹਾਂ ਜੀ ਹਾਂਜੀ

ਹਾਂਜੀ ਹਾਂਜੀ ਮੈਡਮ ਤੁਸੀਂ ਕਦ ਆ ਰਹੇ ਹੋ ਓਕੇ ਓਕੇ ਠੀਕ ਆ ਮੈਡਮ ਠੀਕ ਆ ਇਥੇ ਬਹੁਤ ਦੇਖਣ ਵਾਲੀਆਂ ਪਲੇਸਿਸ ਹੈਗੀਆਂ ਨੇ ਅਤੇ ਪਹਿਲੀ ਤਾਂ ਗੱਲ ਹੈ ਵੀ ਇੱਥੇ ਗੁਰਦੁਆਰਾ ਸਾਹਿਬ ਹੈ ਬੜਾ ਤੀਰਥ ਸਥਾਨ ਹੈ ਸਿੱਖਾਂ ਦਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਉਸ ਤੋਂ ਬਿਨਾਂ ਇੱਕ ਇੱਥੇ ਹਿੰਦੂਆਂ ਦਾ ਮੰਦਿਰ ਆ ਚਕਰੇਸ਼ਵਰੀ ਦੇਵੀ ਮੰਦਿਰ ਹੈ ਅਤੇ ਹਾਂਜੀ ਹਾਂਜੀ ਉਸ ਤੋਂ ਬਿਨਾਂ ਇੱਕ ਮੁਸਲਮਾਨਾਂ ਦੀ ਰੋਜਾ ਸ਼ਰੀਫ ਹੈ ਜਿਹੜੀ ਕਿ ਬੜੀ ਫੇਮਸ ਹੈ ਇਹ ਇਹ ਮੱਕੇ ਤੋਂ ਬਾਅਦ ਸੈਕੰਡ ਜਗ੍ਹਾ ਇਹਨਾਂ ਦੀ ਅਤੇ ਹੋਰ ਵੀ ਬੜੀਆਂ ਧਾਰਮਿਕ ਥਾਵਾਂ ਨੇ ਉਸ ਤੋਂ ਬਿਨਾ ਇੱਥੇ ਹਾਂਜੀ ਹਾਂਜੀ ਤੁਸੀਂ ਮੈਡਮ ਵੈਸੇ ਟਰੇਨ ਆਊਂਗੇ ਨਾ ਸਰਹੰਦ ਤੁਸੀਂ ਸਿੱਧਾ ਉੱਤਰ ਜੋਂਗੇ ਸਟੇਸ਼ਨ 'ਤੇ ਠੀਕ ਆ ਉਥੋਂ ਤੁਸੀਂ ਫਾਟਕ ਮੈਡਮ ਜੇ ਤਾਂ ਤੁਸੀਂ ਰਿਹਾਇਸ਼ ਪੈਸੇ ਨਹੀਂ ਜ਼ਿਆਦਾ ਖਰਚਣਾ ਚਾਹੁੰਦੇ ਫਿਰ ਤਾਂ ਗੁਰਦੁਆਰਾ ਸਾਹਿਬ ਵੀ ਇੱਥੇ ਕਮਰੇ ਮਿਲ ਜਾਣਗੇ ਨਹੀਂ ਨਾ ਇੱਥੇ ਹੋਟਲ ਵਗੈਰਾ ਕਾਫੀ ਹੈਗੇ ਨੇ ਤੁਸੀਂ ਕਿਸੇ ਵੀ ਹੋਟਲ 'ਚ ਰੂਮ ਲੈ ਸਕਦੇ ਓਂ ਕੋਈ ਬਾਹਲਾ ਨਹੀਂ ਦੋ ਹਜ਼ਾਰ ਤੋਂ ਪੱਚੀ ਸੌ ਤੱਕ ਤੁਹਾਨੂੰ ਏ ਸੀ ਰੂਮ ਅਟੈਚ ਬਾਥਰੂਮ ਮਿਲਜੇਗਾ ਗੁਰਦੁਆਰਾ ਸਾਹਿਬ ਦੇ ਬੜੇ ਮੀਨੀਅਮ ਚਾਰਜ ਆ ਲੰਗਰ ਵਗੈਰਾ ਵੀ ਉੱਥੇ ਮੈਡਮ ਤੁਸੀਂ ਛੱਕ ਸਕਦੇ ਹੋ ਠੀਕ ਆ ਜੇ ਤੁਸੀਂ ਹੋਟਲ 'ਚ ਰਹੋਂਗੇ ਤਾਂ ਤੁਹਾਨੂੰ ਉਹਦੇ ਪੇ ਕਰਨੇ ਪੈਣਗੇ ਖਾਣ ਪੀਣ ਲਈ ਵੀ ਇੱਥੇ ਰੈਸਟੋਰੈਂਟ ਬਹੁਤ ਵਧੀਆ ਮੈਡਮ ਜੇ ਤੁਸੀਂ ਖਾਣੇ ਦਾ ਕੋਈ ਚੱਕਰ ਨਹੀਂ ਅਤੇ ਉਸ ਤੋਂ ਬਿਨਾਂ ਇਥੇ ਆਮ ਖਾਸ ਬਾਗ ਹੈਗਾ ਦੇਖਣ ਨੂੰ ਤੁਸੀਂ ਉਥੇ ਵੀ ਤੁਹਾਨੂੰ ਅਸੀਂ ਘੁੰਮਾ ਲਵਾਂਗੇ ਉਥੇ ਵੀ ਫਿਲਮਾਂ ਦੀ ਸ਼ੂਟਿੰਗ ਵਗੈਰਾ ਹੁੰਦੀ ਰਹਿੰਦੀ ਹੈ ਬਹੁਤ ਵਧੀਆ ਦੇਖਣਯੋਗ ਥਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪੁਰਾਣਾ ਬਹੁਤ ਜੀ ਵਧੀਆ ਬਣਿਆ ਹੈ ਅਤੇ ਠੀਕ ਆ ਮੈਡਮ ਤੁਸੀਂ ਕੋਈ ਨਹੀਂ ਆਜਿਓ ਠੀਕ ਆ ਅਸੀਂ ਤੁਹਾਨੂੰ ਹਾਂਜੀ ਤੁਸੀਂ ਤੁਹਾਨੂੰ ਕਾਲ ਕਰਦੇ ਓਕੇ ਠੀਕ ਆ ਠੀਕ ਆ ਓਕੇ ਜੀ ਓਕੇ ਠੀਕ ਓਕੇ ਓਕੇ